ਸੈਰ ਸਪਾਟਾ ਤਾਂ ਮੇਰੀ ਮੰਨੀ ਜਾਵੇ ਤਾਂ ਵਧੀਆ ਚੀਜ਼ ਆ ਲੇਕਿਨ ਹਾਲ ਹੀ ਦੇ ਟਾਈਮ ਜਦੋਂ ਵੀ ਮੈਂ ਸ਼ਾਮ ਨੂੰ ਕਿਤੇ ਬਾਹਰ ਜਾਂਦਾ ਤਾਂ ਮੈਂ ਵੇਖਦਾ ਕਿ ਲੋਕ ਮਤਲਬ ਕਾਫੀ ਘੱਟ ਸੰਖਿਆ ਵਿੱਚ ਮੈਨੂੰ ਲੋਕ ਮਿਲਦੇ ਆ ਜਾਂ ਲੱਭਦੇ ਆ ਅੱਜ ਕੱਲ੍ਹ ਸ਼ਾਮ ਨੂੰ ਜਿਹੜੇ ਸੈਰ ਸਪਾਟਾ ਕਰਨੀਆਂ ਸਵੇਰ ਨੂੰ ਜਦੋਂ ਜਿਹੜੀ ਸੈਰ ਸਪਾਟਾ ਕਰਨ ਜਾਂਦੇ ਰਹੇ ਆ ਅਤੇ ਹੁਣ ਉਹ ਚੀਜ਼ ਕਾਫੀ ਘੱਟ ਹੋ ਚੁੱਕੀ ਹੈ ਅਤੇ ਮੈਨੂੰ ਇਹਦਾ ਕਾਰਨ ਨਹੀਂ ਪਤਾ ਕਿ ਸ਼ਾਇਦ ਉਹਨਾਂ ਨੂੰ ਪਸੰਦ ਨਹੀਂ ਹੈਗਾ ਜਾਂ ਮਤਲਬ ਉਹ ਕਾਫੀ ਟਾਈਮ ਹੁਣ ਫੋਨ 'ਚ ਅਤੇ ਉਹਨਾਂ ਨੂੰ ਘਰ ਬੈਠਣਾ ਪਸੰਦ ਆ ਲੇਕਿਨ ਹਾਂ ਇਹ ਭਾਈਚਾਰੇ ਨੂੰ ਵੀ ਕਾਫੀ ਪ੍ਰਭਾਵਿਤ ਕਰਦਾ ਕਿਉਂਕਿ ਜਿੱਥੇ ਆਪਾਂ ਪਹਿਲਾਂ ਸਾਰੇ ਹੱਸ ਖੇਡ ਕੇ ਬਾਹਰ ਘੁੰਮ ਫਿਰ ਆਉਂਦੇ ਸੀਗੇ ਉੱਥੇ ਅਸੀਂ ਅੱਜ ਘਰ ਬੈਠ ਕੇ ਫੋਨ ਚਲਾ ਕੇ ਅਤੇ ਆਪਣੀ ਫਿਜੀਕਲ ਹੈਲਥ ਤਾਂ ਖਰਾਬ ਕਰਦੇ ਹੀ ਹਾਂ ਮੈਂਟਲ ਵੀ ਨਾ ਹੈਲਥ ਖਰਾਬ ਕਰਦੇ ਪਏ ਹਾਂ ਇਸ ਕਰਕੇ ਅਤੇ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਤਾਂ ਪਹਿਲਾਂ ਤਾਂ ਲੋਕ ਕਾਫੀ ਬਾਹਰ ਜਾਂਦੇ ਰਹੇ ਆ ਲੇਕਿਨ ਹੁਣ ਜਦੋਂ ਮੈਂ ਬਾਹਰ ਜਾਉਨਾ ਤਾਂ ਮੈਨੂੰ ਨਹੀਂ ਲੱਗਦਾ ਕਿ ਕਾਫੀ ਲੋਕ ਜਿੰਨੇ ਪਹਿਲਾਂ ਨਾਲੋਂ ਘੱਟ ਹੀ ਲੋਕ ਹੁੰਦੇ ਆ ਜਿਹੜੇ ਹੁਣ ਬਾਹਰ ਨਿਕਲਦੇ ਏ